ਇੱਕ ਵਾਰ ਦੀ ਗੱਲ ਹੈ ਜਦੋਂ ਕਿ ਮੈਂ ਮਾਤਾ ਵੈਸ਼ਨੋ ਦੇਵੀ ਕਟਰਾ ਜੰਮੂ ਵੱਲ ਗਈ ਸੀ ਉੱਥੇ ਮਾਤਾ ਵੈਸ਼ਨੋ ਦੇਵੀ ਜੀ ਨੇ ਭੈਰੋ ਨੂੰ ਘਾਟੀ ਨੂੰ ਮਾਰ ਕੇ ਪਹਾੜਾਂ ਵਿੱਚ ਆਪਣੀ ਸਥਾਪਿਤ ਜਗ੍ਹਾ ਸਥਾਪਿਤ ਕੀਤੀ ਸੀ ਉੱਥੇ ਵੈਸ਼ਨੋ ਮਾਤਾ ਨੇ ਆਪਣਾ ਸਥਾਨ ਬਣਾਇਆ ਸੀ ਸਾਰੇ ਲੋਕ ਬਹੁਤ ਹੀ ਤਮੰਨਾ ਅਤੇ ਆਸ਼ਾ ਨਾਲ ਉੱਥੇ ਦਰਸ਼ਨ ਕਰਨ ਜਾਂਦੇ ਹਨ ਅਤੇ ਮੈਂ ਵੀ ਉੱਥੇ ਵੈਸ਼ਨੋ ਮਾਤਾ ਦੇ ਦਰਸ਼ਨ ਕਰਨ ਗਈ ਸੀ ਵੈਸ਼ਨੋ ਮਾਤਾ ਜੰਮੂ ਤੋਂ ਇਹ ਵੈਸ਼ਨੋ ਮਾਤਾ ਤੋਂ ਇਲਾਵਾ ਜੰਮੂ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਦੇਖਣ ਵਾਲੀਆਂ ਹਨ ਜਿਵੇਂ ਕਿ ਮਹਾਰਾਜਾ ਹਰੀ ਸਿੰਘ ਪੈਲਸ ਚੀਚੀ ਮਾਤਾ ਬਾਵੇ ਵਾਲੀ ਮਾਤਾ ਆਦਿ ਬਹੁਤ ਹੀ ਸਾਰੀਆਂ ਦੇਖਣ ਵਾਲੀ ਜਗ੍ਹਾ ਹਨ ਜੰਮੂ ਤੋਂ ਇਲਾਵਾ ਜਦੋਂ ਮੈਂ ਜੰਮੂ ਕਟਰੇ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਸੀ ਅਤੇ ਮੈਂ ਟ੍ਰੇਨ ਵਿੱਚ ਬੈਠੀ ਹੋਈ ਸੀ ਅਤੇ ਮੈਨੂੰ ਇੱਕ ਸੈਲਾਨੀ ਮੇਰੇ ਨਾਲ ਦਾ ਸੈਲਾਨੀ ਬੈਠਿਆ ਜੋ ਕਿ ਮੇਰੇ ਨਾਲ ਗੱਲਾਂ ਪੈ ਗਿਆ ਅਤੇ ਮੈਂ ਉਸਨੂੰ ਜੰਮੂ ਬਾਰੇ ਦੱਸਦੀ ਸੀ ਕਿ ਮੈਂ ਹੁਣੇ ਵੈਸ਼ਨੋ ਮਾਤਾ ਦੇ ਦਰਸ਼ਨ ਕਰਕੇ ਆਈ ਹਾਂ ਕਟਰਾ ਵੱਲ ਜੰਮੂ ਵੱਲ ਘੁੰਮ ਕੇ ਆਈ ਹਾਂ ਅਤੇ ਜੰਮੂ ਦੀਆਂ ਹੋਰ ਵੀ ਜਿੰਨੀਆਂ ਜਗ੍ਹਾਵਾਂ 'ਤੇ ਮੈਂ ਗਈ ਹੋਈ ਸੀ ਉਹ ਜਗ੍ਹਾਵਾਂ ਮੈਂ ਉਹਨਾਂ ਨਾਲ ਸ਼ੇਅਰ ਕੀਤੀਆਂ ਅਤੇ ਉਹਨਾਂ ਨੂੰ ਦੱਸਿਆ ਕਿ ਜੰਮੂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਹਨ ਜੋ ਕਿ ਉਹਨਾਂ ਨੂੰ ਦੇਖਣਾ ਚਾਹੀਦਾ ਜਿਵੇਂ ਕਿ ਕਸ਼ਮੀ ਕਸ਼ਮੀਰ ਦੀ ਘਾਟੀ ਬਹੁਤ ਹੀ ਸੁੰਦਰਤਾ ਵਾਲੀ ਹੈ ਬਹੁਤ ਹੀ ਮਨਮੋਹਕ ਵਾਲੀ ਹੈ ਕਸ਼ਮੀਰ ਦੀ ਧਰਤੀ ਵਿੱਚ ਅਰਸ਼ੀ ਜੋ ਕਿ ਅਰਸ਼ੀ ਰੂਹਾਂ ਚਮਕਦੀਆਂ ਪ੍ਰਤੀਤ ਹੁੰਦੀਆਂ ਹਨ ਅਰਸ਼ੀ ਰਮਜ਼ਾ ਛਲਕਦੀਆਂ ਪ੍ਰਤੀਤ ਹੁੰਦੀਆਂ ਹਨ ਕਸ਼ਮੀਰ ਤੋਂ ਇਲਾਵਾ ਸ਼੍ਰੀਨਗਰ ਸ਼੍ਰੀਨਗਰ ਵਿੱਚ ਵੀ ਬਹੁਤ ਹੀ ਦੇਖਣ ਵਾਲੀ ਜਗ੍ਹਾ ਹੈ ਸ਼੍ਰੀਨਗਰ ਜਿਵੇਂ ਕਿ ਹੋਰ ਸ਼ਿਮਲਾ ਸ਼ਿਮਲਾ ਦੇਖਣ ਵਾਲੀ ਜਗ੍ਹਾ ਜਿੱਥੇ ਜਿੱਥੇ ਮੈਂ ਗਈ ਹੋਈ ਹਾਂ ਮੈਂ ਉਹ ਸਾਰੀਆਂ ਜਗ੍ਹਾਵਾਂ ਜੋ ਕਿ ਆਪਣੇ ਨਾਲ ਦੇ ਸੈਲਾਨੀ ਨੂੰ ਦੱਸੀਆਂ ਸੀ ਉਹਨਾਂ ਨਾਲ ਜੋ ਕੁਛ ਮੇਰੇ ਨਾਲ ਉੱਥੇ ਮੈਨੂੰ ਬਹੁਤ ਵਧੀਆ ਚੀਜ਼ਾਂ ਲੱਗੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗੀਆਂ ਉੱਥੋਂ ਦੀਆਂ ਉਹ ਸਾਰੀਆਂ ਮੈਂ ਉਹਨਾਂ ਨਾਲ ਸ਼ੇਅਰ ਕੀਤੀਆਂ ਸਨ